ਹੈਲੋ ਹਾਂਜੀ ਅਰਸ਼ਦੀਪ ਸਿੰਘ ਬੋਲਦੇ ਹੋ ਸਤਿ ਸ਼੍ਰੀ ਅਕਾਲ ਜੀ ਅਰਸ਼ਦੀਪ ਸਿੰਘ ਜੀ ਮੈਂ ਜਰਨਲ ਆਫ ਟੈਕਨੋਲਜੀ ਇਨ ਐਗਰੀਕਲਚਰ ਤੋਂ ਬੋਲ ਰਿਹਾ ਰਾਮ ਸਿੰਘ ਤੁਸੀਂ ਕੰਮ ਕਰ ਰਹੇ ਸੀ ਨਾ ਇੰਟਰਨੈੱਟ ਔਫ ਥਿੰਗ ਦਾ ਐਪਲੀਕੇਸ਼ਨਜ਼ ਆਫ ਇੰਟਰਨੈੱਟ ਔਫ ਥਿੰਗਜ਼ ਇਨ ਐਗਰੀਕਲਚਰ ਪ੍ਰੋਜੈਕਟ ਪੂਰਾ ਹੋ ਗਿਆ ਅਤੇ ਉਸ ਪ੍ਰੋਜੈਕਟ ਦੀਆਂ ਕੀ ਆਊਟਕਮਸ ਨੇ ਅਸੀਂ ਇੱਕ ਰਿਪੋਰਟ ਤਿਆਰ ਕਰ ਰਹੇ ਹਾਂ ਜਿਹੜਾ ਸਾਡੇ ਜਰਨਲ ਦੇ ਵਿੱਚ ਪਬਲਿਸ਼ ਹੋਣੀ ਹੈ ਟੈਕਨੋਲੋਜੀ ਦਾ ਯੂਜ਼ ਕੀ ਹੈਗਾ ਜਾਂ ਵਰਤੋਂ ਕਿੰਨੀ ਹੈਗੀ ਹੈ ਐਗਰੀਕਲਚਰ ਦੇ ਵਿੱਚ ਕਿਹੜੇ ਕਿਹੜੇ ਐਸਪੈਕਟਸ 'ਤੇ ਉਸ ਬਾਰੇ ਕੁਝ ਦੱਸੋਂਗੇ ਤੂੰ ਤੁਹਾਡੇ ਤੁਸੀਂ ਕੀ ਰਿਸਰਚ ਦੇ ਵਿੱਚ ਤੁਹਾਡੀਆਂ ਤੁਸੀਂ ਕੀ ਫਾਇੰਡ ਆਊਟ ਕੀਤਾ ਅਲੱਗ ਅਲੱਗ ਥਾਵਾਂ ਤੋਂ ਡਾਟਾ ਇ ਇਕੱਠਾ ਕਰਦਾ ਤੁਹਾਡੇ ਸੈਂਸਰ ਜਿਹੜੇ ਲਾ ਕੇ ਉਹ ਉਹ ਉਹ ਉਹ ਜਿਹੜਾ ਡਾਟਾ ਹੈਗਾ ਤੁਹਾਡੇ ਆਪਣੇ ਸਰਵਰ 'ਤੇ ਸਟੋਰ ਹੁੰਦਾ ਓਕੇ ਅੱਛਾ ਕੀ ਇਨਫਰਮੇਸ਼ਨ ਪ੍ਰੋਵਾਈਡ ਕਰਦਾ ਜਿਹੜਾ ਜਿਹੜਾ ਐੱਲਗੋਰਿਦਮ ਤੁਸੀਂ ਬਣਾਇਆ ਹੈਗਾ ਟੈਕਨੋਲੋਜੀ ਦਾ ਕਿ ਕਿਹੜੀਆ ਕਿਹੜੀਆਂ ਫੈਕਟਰ ਜਿਹੜੇ ਹੈਗੇ ਹੈ ਜਾਂ ਕਿਹੜੇ ਕਿਹੜੇ ਪੱਖ ਜਿਹੜੇ ਹੈਗੇ ਹੈ ਉਹ ਦੱਸਦਾ ਹੈਗਾ ਇਹਦੇ ਨਾਲ ਜਿਹੜੀਆਂ ਕੋਲਡ ਸਟੋਰ ਦੇ ਵਿੱਚ ਰੱਖੀਆਂ ਜਾਣ ਵਾਲੀਆਂ ਫਸਲਾਂ ਨੇ ਉਨ੍ਹਾਂ ਦੀ ਕਿੰਨੀ ਕਿੰਨੀ ਕੁ ਲਾਈਫ ਜਿਹੜੀ ਉਨ੍ਹਾਂ ਚੀਜ਼ਾਂ ਮਤਲਬ ਜ ਉਹ ਕਿੰਨਾ ਚਿਰ ਫਰੈਸ਼ ਰਹਿ ਸਕਦੀਆਂ ਨੇ ਜਾਂ ਤਰੋਤਾਜ਼ਾ ਰਹਿ ਸਕਦੀਆਂ ਨੇ ਓਕ ਥੈਂਕ ਯੂ ਜੀ ਥੈਂਕ ਯੂ